ਬੈਂਕ ਤੋਂ ਇਲਾਵਾ ਜਿਹੜੇ ਲੋਕ ਹਨ ਉਹ ਕਈ ਮੌਕੇ ਆਪਣੇ ਯਾਰ ਰਿਸ਼ਤੇਦਾਰਾਂ ਤੋਂ ਜਾਂ ਪਰਿਵਾਰ ਵਾਲਿਆਂ ਤੋਂ ਪੈਸੇ ਲੈ ਲੈਂਦੇ ਹਨ ਇਸ ਤੋਂ ਇਲਾਵਾ ਉਹ ਕਈ ਵਾਰੀ ਜਿਹੜੇ ਪ੍ਰਾਈਵੇਟ ਫਾਈਨੈਂਸਰਸ ਹੁੰਦੇ ਹਨ ਉਹਨਾਂ ਤੋਂ ਵੀ ਪੈਸੇ ਲੈ ਲੈਂਦੇ ਆ ਜੋ ਬਾਅਦ 'ਚ ਉਹਨਾਂ ਨੂੰ ਬਹੁਤ ਜ਼ਿਆਦਾ ਇੰਟਰਸਟ ਚਾਰਜ ਕਰਦੇ ਹਨ ਉਹਨਾਂ ਦਾ ਇੰਟਰਸਟ ਰੇਟ ਕਈ ਮੌਕੇ ਇੱਕ ਮਹੀਨੇ ਦੇ ਅੰਦਰ ਅੰਦਰ ਤਿੰਨ ਤੋਂ ਚਾਰ ਪ੍ਰਸੈਂਟ ਵੀ ਹੁੰਦਾ ਹੈ ਕਈ ਥਾਵਾਂ 'ਤੇ ਦੇਖਿਆ ਗਿਆ ਹੈ ਜਿਹੜਾ ਇੰਟਰਸਟ ਰੇਟ ਆ ਉਹ ਦਸ ਪ੍ਰਸੈਂਟ ਤੱਕ ਉਹ ਚਾਰਜ ਕਰਦੇ ਆ ਜਿਹੜੇ ਲੋਕਲ ਫਾਈਨੈਂਸਰ ਹਨ ਇਸ ਤੋਂ ਉਲਟ ਜੇ ਬੈਂਕ 'ਚ ਦੇਖਿਆ ਜਾਵੇ ਜੋ ਬੈਂਕ ਚੋਂ ਵਿਆਜ ਮਿਲਦਾ ਆ ਉਹ ਸਲਾਨਾ ਇੰਟਰਸਟ ਸਲਾਨਾ ਵਿਆਜ ਸਲਾਨਾ ਵਿਆਜ ਲੈਂਦੇ ਹਨ ਉਹਨਾਂ ਦਾ ਸਲਾਨਾ ਵਿਆਜ ਦਰ ਜਿਹੜਾ ਹੁੰਦਾ ਆ ਉਹ ਬਾਰਾਂ ਤੋਂ ਪੰਦਰਾਂ ਪ੍ਰਸੈਂਟ ਦੇ ਅੰਦਰ ਅੰਦਰ ਹੁੰਦਾ ਹੈ ਜ਼ਿਆਦਾ ਤੋਂ ਜ਼ਿਆਦਾ ਪੰਦਰਾਂ ਪ੍ਰਸੈਂਟ ਹੀ ਲੈਂਦੇ ਹਨ ਪਰ ਜਿਹੜੇ ਦੂਸਰੇ ਫਾਈਨੈਂਸਰਸ ਹੈਗੇ ਆ ਬੈਂਕ ਤੋਂ ਇਲਾਵਾ ਜਿਹਨਾਂ ਨੂੰ ਅਸੀਂ ਵਿਆਜ ਕਰਤਾ ਵੀ ਕਹਿ ਦਿੰਦੇ ਹਾਂ ਜਾਂ ਸ਼ਾਹੂਕਾਰ ਵੀ ਕਹਿ ਦਿੰਦੇ ਹਾਂ ਜਿਹੜੇ ਸ਼ਾਹੂਕਾਰਾਂ ਤੋਂ ਆਪਾਂ ਪੈਸਾ ਲੈਂਦੇ ਹਾਂ ਉਹ ਚਾਰਜ ਕਰਦੇ ਹਨ ਮਹੀਨੇ ਦੇ ਦੋ ਤੋਂ ਚਾਰ ਪ੍ਰਸੈਂਟ ਕਈ ਮੌਕੇ ਪੰਜ ਜਾਂ ਛੇ ਪ੍ਰਸੈਂਟ ਵੀ ਚਾਰਜ ਕਰ ਲੈਂਦੇ ਹਨ ਉਹ ਮਹੀਨੇ ਦੇ ਆਧਾਰ 'ਤੇ ਚਾਰਜ ਕਰਦੇ ਹਨ ਅਤੇ ਜੇ ਪੈਸੇ ਉਹਨਾਂ ਦੇ ਟਾਈਮ ਸਿਰ ਨਾ ਦਿੱਤੇ ਜਾਣ ਤਾਂ ਉਹ ਆਪਣੀ ਰਕਮ ਜਿਹੜੀ ਆ ਉਹ ਡਬਲ ਅਤੇ ਕਈ ਮੌਕੇ ਤਿੰਨ ਗੁਣਾ ਵੀ ਵਧਾ ਦਿੰਦੇ ਹਨ ਆਪਣਾ ਵਿਆਜ ਜੇ ਮੂਲ ਨਾਲੋਂ ਵਿਆਜ ਉਹਨਾਂ ਦਾ ਕਈ ਵਾਰੀ ਜ਼ਿਆਦਾ ਵੱਧ ਜਾਂਦਾ ਹੈ